ਹੈਲੋ ਹਾਂਜੀ ਮੈਮ ਤੁਸੀਂ ਸਿਮਰਨ ਬੋਲ ਰਹੇ ਟ੍ਰੈਵਲਸ ਤੋਂ ਗੱਲ ਕਰ ਰਹੇ ਹੋ ਮੈਮ ਮੈਂ ਜਗਮੀਤ ਗੱਲ ਕਰ ਰਹੀ ਹਾਂ ਅਤੇ ਮੈਂ ਨਾ ਪੰਜਾਬ ਘੁੰਮਣ ਆਉਣਾ ਹੈ ਇੱਕ ਹਫ਼ਤੇ ਲਈ ਅਤੇ ਮੈਨੂੰ ਘੁੰਮਣ ਲਈ ਕੈਬ ਚਾਹੀਦੀ ਹੋਵੇਗੀ ਨਾਲੇ ਸਟੇਅ ਵੀ ਅਤੇ ਮੈਨੂੰ ਇੱਕ ਟੂਰੀਸਟ ਗਾਈਡ ਵੀ ਚਾਹੀਦਾ ਹੋਵੇਗਾ ਜਿਹੜਾ ਮੈਨੂੰ ਗਾਈਡ ਕਰ ਦੇਵੇ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੇ ਕਿਹੜੇ ਇਤਿਹਾਸਿਕ ਗੁਰਦੁਆਰੇ ਨੇ ਕੁੱਝ ਹੋਰ ਜਗਾਵਾਂ ਹੈ ਜਿੱਥੇ ਜਿੱਥੇ ਮੈਂ ਘੁੰਮ ਸਕਦੀ ਹਾਂ

ਮੈਮ ਮੈਂ ਅੰਮ੍ਰਿਤਸਰ ਸ਼ਹਿਰ ਘੁੰਮਣਾ ਚਾਹੁੰਦੀ ਹਾਂ ਨਾਲ਼ੇ ਅਨੰਦਪੁਰ ਸਾਹਿਬ ਘੁੰਮਣਾ ਚਾਹੁੰਦੀ ਹਾਂ ਮੇਨਲੀ ਬਾਕੀ ਤੁਸੀਂ ਮੈਨੂੰ ਗਾਈਡ ਕਰੋ ਹੋਰ ਮੈਂ ਕੀ ਕਿਹੜੀ ਕਿਹੜੀ ਜਗ੍ਹਾਂ ਜਿਹੜੀ ਹੈ ਉਹ ਘੁੰਮ ਸਕਦੀ ਹਾਂ ਅਤੇ ਬਾਕੀ ਬਜਟ ਵਗੈਰਾ ਵੀ ਤੁਸੀਂ ਦੇਖਲੋ ਕਿ ਜ਼ਿਆਦਾ ਖ਼ਰਚਾ ਵੀ ਨਾ ਹੋਵੇ ਮੇਰਾ ਜੀ ਮੈਮ

ਠੀਕ ਹੈ ਮੈਮ ਠੀਕ ਹੈ ਮੈਂ ਬਾਕੀ ਡੀਟੇਲਜ ਵਗੈਰਾ ਤੁਹਾਡੇ ਨਾਲ਼ ਬਾਅਦ 'ਚੋ ਗੱਲ ਕਰ ਲੈਂਦੀ ਆ ਥੈਂਕ ਯੂ ਮੈੈਨੂੰ ਗਾਈਡ ਕਰਨ ਲਈ